ਮੇਰੀ ਸਭ ਤੋਂ ਆਲੀਸ਼ਾਨ ਯਾਤਰਾ ਵ੍ਰਿੰਦਾਬਨ ਦੀ ਰਹੀ ਹੀ ਜੋ ਕਿ ਮੈਂ ਪਿਛਲੇ ਸਾਲ ਐਪ੍ਰਲ ਦੇ ਮਹੀਨੇ ਵਿੱਚ ਕੀਤੀ ਸੀ ਉਦੋਂ ਬਹੁਤ ਹੀ ਜ਼ਿਆਦਾ ਐਕਸਾਈਟਡ ਉੱਥੇ ਜਾਣ ਲਈ ਕਿਉਂਕਿ ਮੈਂ ਬਹੁਤ ਸੁਣਿਆ ਉਸ ਜਗ੍ਹਾ ਦੇ ਬਾਰੇ ਜਦੋਂ ਅਸੀਂ ਉੱਥੇ ਗਏ ਸਵੇਰੇ ਜਾ ਕੇ ਸਭ ਤੋਂ ਪਹਿਲਾਂ ਤਿਆਰ ਹੋਏ ਇਸ਼ਨਾਨ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਸਿੱਧਾ ਬਾਂਕੇ ਬਿਹਾਰੀ ਦੇ ਮੰਦਿਰ ਗਏ ਜਿੱਥੇ ਜਾ ਕੇ ਸਾਨੂੰ ਬਹੁਤ ਹੀ ਆਨੰਦ ਆਇਆ ਉੱਥੇ ਜਾ ਕੇ ਇੱਦਾਂ ਲੱਗਦਾ ਕਿ ਜਿਵੇਂ ਤੁਹਾਡੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਖ਼ਤਮ ਹੋ ਜਾਣਗੀਆਂ ਤੁਹਾਨੂੰ ਇੱਕ ਬਹੁਤ ਹੀ ਪੋਜੀਟਿਵ ਐਨਰਜੀ ਫੀਲ ਹੁੰਦੀ ਹੈ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਲਈ ਬਹੁਤ ਜ਼ਿਆਦਾ ਪ੍ਰੇਰਿਤ ਹੁੰਦੇ ਹੋ ਉਸ ਤੋਂ ਬਾਅਦ ਅਸੀਂ ਰਾਧਾ ਵੱਲਭ ਦੇ ਮੰਦਿਰ ਗਏ ਉੱਥੇ ਪ੍ਰੇਮ ਮੰਦਿਰ ਵੀ ਹੀ ਇਸਕੌਣ ਮੰਦਿਰ ਵੀ ਹੈ ਸਾਰੇ ਮੰਦਿਰਾਂ 'ਚ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਉੱਥੇ ਜਾ ਕੇ ਉੱਥੇ ਜਾ ਕੇ ਇੱਦਾਂ ਲੱਗਾ ਜਿਵੇਂ ਅਸੀਂ ਜੰਨਤ 'ਚ ਆ ਗਏ ਹਾਂ ਉਹ ਬਹੁਤ ਹੀ ਸੋਹਣੀ ਜਗ੍ਹਾ ਹੈ ਜਿੱਥੇ ਕਿਸੇ ਦੇ ਵਿੱਚ ਵੀ ਕੋਈ ਵੀ ਬੋ ਮਿਜਾਜ ਨਹੀਂ ਹੈਗਾ ਸਾਰੇ ਇੱਕ ਦੂਜੇ ਨੂੰ ਬਹੁਤ ਚੰਗੇ ਤਰੀਕੇ ਨਾਲ ਬੁਲਾਉਂਦੇ ਹਨ ਜੇ ਕਿਸੇ ਕੋਲ ਕੋਈ ਗਲਤੀ ਵੀ ਹੋ ਜਾਵੇ ਤਾਂ ਉਹ ਲੜਨ ਦੀ ਬਜਾਇ ਉੱਥੇ ਸਿਰਫ ਰਾਧਾ ਰਾਧਾ ਕਹਿੰਦੇ ਹਨ ਅਤੇ ਅੱਗੇ ਵੱਧਦੇ ਹਨ ਉੱਥੇ ਜਾ ਕੇ ਬਹੁਤ ਹੀ ਵਧੀਆ ਲੱਗਾ ਮਨ ਨੂੰ ਬਹੁਤ ਖੁਸ਼ੀ ਮਿਲੀ ਉਸ ਤੋਂ ਬਾਅਦ ਅਸੀਂ ਮਥੁਰਾ ਵੀ ਗਏ ਅਸੀਂ ਰਾਧਾਰਾਣੀ ਦੇ ਮਹਿਲ ਬਰਸਾਨੇ ਵੀ ਹੋ ਕੇ ਆਏ ਅਤੇ ਉੱਥੇ ਇੱਕ ਬਰਸਾਨੇ ਦੇ ਮਹਿਲ ਤੋਂ ਇੱਕ ਇੱਦਾਂ ਦਾ ਵਿਊ ਆਉਂਦਾ ਹੈ ਕਿ ਜਿਹਦੇ ਨਾਲ ਤੁਹਾਡੀ ਰੂਹ ਅੰਦਰੋਂ ਖੁਸ਼ ਹੋ ਜਾਂਦੀ ਹੈ ਤੁਹਾਨੂੰ ਉੱਥੇ ਜਾ ਕੇ ਇੰਝ ਲੱਗਦਾ ਜਿਵੇਂ ਰੱਬ ਸਵੈਯਮ ਤੁਹਾਡੇ ਸਾਹਮਣੇ ਹੈਗਾ ਅਤੇ ਤੁਹਾਨੂੰ ਅੰਦਰੋਂ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਇੱਦਾਂ ਦੀਆਂ ਬਹੁਤ ਘੱਟ ਜਗਾਵਾਂ ਹਨ ਜਿੱਥੇ ਜਾ ਕੇ ਤੁਹਾਨੂੰ ਬਹੁਤ ਹੀ ਚੰਗਾ ਮਹਿਸੂਸ ਹੋਵੇ ਤੁਹਾਨੂੰ ਪੋਜ਼ੀਟਿਵ ਵਾਈਬਸ ਆਉਣ ਬਸ ਇਹ ਚੀਜ਼ ਸਿਰਫ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਵੀ ਹੁੰਦੀ ਹੈ ਜਿੱਥੇ ਜਾ ਕੇ ਤੁਹਾਨੂੰ ਅੰਦਰੋਂ ਦਿਲੋਂ ਸ਼ਾਂਤੀ ਮਿਲਦੀ ਹੈ ਅਤੇ ਤੁਹਾਡਾ ਮਨ ਕਰਦਾ ਹੈ ਕਿ ਇੱਥੇ ਹੀ ਰਹੀਏ ਮੈਂ ਉਸ ਯਾਤਰਾ ਨੂੰ ਕਦੇ ਵੀ ਨਹੀਂ ਭੁੱਲਾਂਗੀ ਉਹ ਮੇਰੇ ਲਈ ਬਹੁਤ ਹੀ ਆਨੰਦਮਈ ਯਾਤਰਾ ਸੀ ਜੋ ਕਿ ਮੈਂ ਹਰ ਵਾਰ ਹਰ ਸਾਲ ਮਹਿਸੂਸ ਕਰਨੀ ਚਾਵਾਂਗੀ ਅਤੇ ਉਸਨੂੰ ਜੀਉਣਾ ਚਾਹਵਾਂਗੀ